ਸਾਡੇ ਖੇਤਰ ਵਿੱਚ ਦਸਵੀਂ ਤੋਂ ਬਾਅਦ ਵਿਦਿਆਰਥੀਆਂ ਲਈ ਬਹੁਤ ਸਾਰੀ ਤਰਜੀਹਾਂ ਹਨ ਜਿਵੇਂ ਕਿ ਦਸਵੀਂ ਤੋਂ ਬਾਅਦ ਵਿਦਿਆਰਥੀ ਡਿਪਲੋਮਾ ਕਰ ਸਕਦੇ ਹਨ ਡਿਪਲੋਮਾ ਔਫ ਫੋਟੋਗ੍ਰਾਫੀ ਡਿਪਲੋਮਾ ਔਫ ਇੰਜੀਨੀਅਰਿੰਗ ਔਰ ਡਿਪਲੋਮਾ ਔਫ ਆਰਟਸ ਅਜਿਹੇ ਸਾਰੇ ਡਿਪਲੋਮੇ ਵਿਦਿਆਰਥੀ ਕਰ ਸਕਦੇ ਹਨ ਇਸ ਤੋਂ ਇਲਾਵਾ ਵਿਦਿਆਰਥੀ ਬਾਰ੍ਹਵੀਂ ਵਿੱਚ ਆਰਟਸ ਨੋਨ ਮੈਡੀਕਲ ਮੈਡੀਕਲ ਕਮਰਸ ਆਦਿ ਸਟ੍ਰੀਮਸ ਵੀ ਲੈ ਸਕਦੇ ਹਨ ਆਰਟਸ ਵਿੱਚ ਵਿਦਿਆਰਥੀ ਆਪਣਾ ਟੀਚਿੰਗ ਲਾਈਨ ਅਤੇ ਆਦਿ ਹੋਰ ਕੁਛ ਵੀ ਕਰ ਸਕਦੇ ਹਨ ਅਤੇ ਨੋਨ ਮੈਡੀਕਲ ਵਿੱਚ ਬੱਚੇ ਇੰਜੀਨੀਅਰਿੰਗ ਅਤੇ ਹੋਰ ਕੁਛ ਵੀ ਕਰ ਸਕਦੇ ਹਨ ਅਤੇ ਮੈਡੀਕਲ ਵਿੱਚ ਬੱਚੇ ਨਰਸਿੰਗ ਲਾਈਨ ਵਿੱਚ ਜਾਂਦੇ ਹਨ ਡੋਕਟਰ ਬਣਦੇ ਹਨ ਅਤੇ ਉਸ ਤੋਂ ਬਾਅਦ ਕਮਰਸ ਵਿੱਚ ਬੱਚੇ ਬੈਂਕਿੰਗ ਬੈਂਕਿੰਗ ਸੈਕਟਰ ਵਿੱਚ ਜਾਂਦੇ ਹਨ ਅਤੇ ਸਾਡੇ ਖੇਤਰ ਵਿੱਚ ਇਹਨਾਂ ਸਾਰੀਆਂ ਸਟ੍ਰੀਮਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਤਰਜੀਹਾਂ ਹਨ ਜੋ ਕਿ ਬੱਚੇ ਦਸਵੀਂ ਤੋਂ ਬਾਅਦ ਕਰ ਸਕਦੇ ਹਨ